ਨਮਸਕਾਰ ਮੇਰਾ ਨਾਮ ਪੂਜਾ ਹੈ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਪਠਾਨਕੋਟ ਦੇ ਨਾਲ ਢੇਸੀਆਂ ਪਿੰਡ ਜਿੱਥੇ ਕਿ ਰਹਿੰਦੇ ਹਾਂ ਅਸੀਂ ਸਾਡੇ ਪਿੰਡ ਵਿੱਚ ਖੇਤੀਬਾੜੀ ਦਾ ਬਹੁਤ ਹੀ ਕੰਮ ਹੈ ਅਤੇ ਖੇਤੀਬਾੜੀ ਵਿੱਚ ਸਭ ਤੋਂ ਜ਼ਰੂਰੀ ਕੰਮ ਖੇਤਾਂ ਨੂੰ ਪਾਣੀ ਲਗਾਉਣਾ ਅ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਹੈ ਕਿ ਕਣਕ ਅਤੇ ਝੋਨਾ ਬੀਜਣ ਲਈ ਬਹੁਤ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਪਾਣੀ ਈ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਰਕਾਰ ਨੇ ਘਰ ਘਰ ਪਾਣੀ ਦੀ ਯੋਜਨਾ ਵੀ ਸ਼ੁਰੂ ਕੀਤੀ ਹੈ ਜਿਸ ਨਾਲ ਹਰ ਘ ਜਗ੍ਹਾ ਪਾਣੀ ਆਉਂਦਾ ਹੈ ਅਤੇ ਖੇਤਾਂ ਵਿੱਚ ਖੂਹ ਅ ਕੱਢ ਕੇ ਮੋਟਰਾਂ ਅਤੇ ਬੰਬੀਆਂ ਵੀ ਲਗਾਈਆਂ ਹਨ ਜਿਹਨਾਂ ਰਾਹੀਂ ਹੀ ਅਸੀਂ ਖੇਤਾਂ ਨੂੰ ਪਾਣੀ ਲਗਾ ਸਕਦੇ ਹਾਂ ਬੰਬੀਆਂ ਰਾਹੀਂ ਅ ਪਾਣੀ ਆਉਂਦਾ ਹੈ ਅਤੇ ਵੱਟਾਂ ਰਾਹੀਂ ਸਾਰੇ ਖੇਤਾਂ ਵਿੱਚ ਪਾਣੀ ਫੈਲ ਜਾਂਦਾ ਹੈ ਅਤੇ ਸਾਰੇ ਖੇਤ ਹਰੇ ਭਰੇ ਹੋ ਜਾਂਦੇ ਹਨ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਖੇਤਾਂ ਵਿੱਚ ਪਾਣੀ ਲਗਾਉਣ ਦੇ ਪਾਣੀ ਲਗਾਉਣ ਨਾਲ ਅ ਖੇਤ ਹਰੇ ਭਰੇ ਹੋ ਜਾਂਦੇ ਹਨ ਧੰਨਵਾਦ